ਦੌੜਨਾ ਸਰੀਰ ਦੇ ਲਈ ਇੱਕ ਬਹੁਤ ਅੱਛੀ ਕਸਰਤ ਹੈ ਹਰੇਕ ਇਨਸਾਨ ਨੂੰ ਮਤਲਬ ਕਿਹਾ ਜਾਂਦਾ ਹੈ ਕਿ ਹਜ਼ਾਰ ਦੋ ਹਜ਼ਾਰ ਕਦਮ ਤਾਂ ਦਿਨ ਵਿੱਚ ਦੌੜਨੇ ਚਾਹੀਦੇ ਹਨ ਦੌੜਨ ਵੇਲੇ ਜਿਹੜਾ ਟਾਈਮ ਹੈ ਉਹ ਜ਼ਿਆਦਾਤਰ ਸਵੇਰ ਦਾ ਵਧੀਆ ਮੰਨਿਆ ਜਾਂਦਾ ਕਿ ਆਪਾਂ ਨੂੰ ਸਵੇਰੇ ਹੀ ਦੌੜਨਾ ਚਾਹੀਦਾ ਹੈ ਕਿਉਂਕਿ ਉਸ ਟਾਈਮ ਇੱਕ ਤਾਂ ਮਤਲਬ ਆਸੇ ਪਾਸੇ ਜ਼ਿਆਦਾ ਪ੍ਰਦੂਸ਼ਣ ਨਹੀਂ ਹੁੰਦਾ ਵਧੀਆ ਸਾਫ਼ ਸੁਥਰਾ ਮਾਹੌਲ ਹੁੰਦਾ ਅਤੇ ਜ਼ਿਆਦਾ ਆਵਾਜਾਈ ਵੀ ਨਹੀਂ ਹੁੰਦੀ ਅਤੇ ਤੁਹਾਨੂੰ ਹਮੇਸ਼ਾ ਨਰਮ ਜਿਹੜੀ ਜ਼ਮੀਨ ਹੈ ਉਹਦੇ 'ਤੇ ਹੀ ਦੌੜਨਾ ਚਾਹੀਦਾ ਅਤੇ ਇਹਦੇ ਆਪਾਂ ਨੂੰ ਬਹੁਤ ਫਾਇਦੇ ਹਨ ਮਾਨਸਿਕ ਵੀ ਅਤੇ ਸਰੀਰਕ ਵੀ ਕਿਉਂਕਿ ਇਹਦੇ ਨਾਲ ਪੂਰੇ ਸਰੀਰ ਦੀ ਸਿਰ ਤੋਂ ਲੈ ਕੇ ਪੈਰਾਂ ਤੱਕ ਕਸਰਤ ਹੁੰਦੀ ਹੈ ਅਤੇ ਆਪਣਾ ਜਿਹੜਾ ਖੂਨ ਹੈ ਉਹ ਅੱਛੀ ਤਰ੍ਹਾਂ ਪੂਰੇ ਸਰੀਰ ਵਿੱਚ ਦੌੜਦਾ ਹੈ ਆਪਣੇ ਫੇਫੜਿਆਂ ਨੂੰ ਖੁੱਲ੍ਹ ਕੇ ਖੁੱਲ੍ਹ ਉਹ ਖੁੱਲ੍ਹਦੇ ਹਨ ਅਤੇ ਬਹੁਤ ਮਾਤਰਾ 'ਚ ਓਕਸੀਜਨ ਫੇਫੜਿਆਂ ਤੱਕ ਜਾਂਦੀ ਹੈ ਅਤੇ ਔਰ ਜੇਕਰ ਤੁਸੀਂ ਸਵੇਰੇ ਦੋ ਅੱਧਾ ਕੁ ਘੰਟਾ ਵੀ ਨਿਕਾਲਦੇ ਹੋ ਦੌੜਨ ਵਾਸਤੇ ਜਾਂ ਕੁਛ ਹਲਕੇ ਕਦਮਾਂ ਦੀ ਚਾਲ ਵੀ ਕਰਦੇ ਹੋ ਤਾਂ ਵੀ ਇਹ ਤੁਹਾਡੇ ਲਈ ਬਹੁਤ ਵਧੀਆ ਹੈ ਅਤੇ ਇਹਦੇ ਫਿਰ ਜੇਕਰ ਆਪਣਾ ਸਰੀਰ ਵਧੀਆ ਰਹੇਗਾ ਸਰੀਰ ਤੰਦਰੁਸਤ ਹੈ ਤਾਂ ਆਪਾਂ ਮਾਨਸਿਕ ਤੌਰ 'ਤੇ ਵੀ ਵਧੀਆ ਰਹਾਂਗੇ ਖੁਸ਼ ਰਹਾਂਗੇ ਅਤੇ ਹਾਂ ਦੌੜਨ ਤੋਂ ਬਾਅਦ ਮੈਨੂੰ ਆਰਾਮ ਮਹਿਸੂਸ ਹੁੰਦਾ ਹੈ ਕੁਛ ਦੇਰ ਬਾਅਦ ਜਦੋਂ ਸਾਂਸ ਆਪਣੀ ਜਿਹੜੀ ਹੈ ਜਿਹੜਾ ਸਾਹ ਕੰਟਰੋਲ ਹੋ ਜਾਂਦੇ ਹੈ ਉਸ ਤੋਂ ਬਾਅਦ ਸਰੀਰ ਨੂੰ ਬਹੁਤ ਹਲਕਾ ਫੁਲਕਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਐਨਰਜੀ ਸਰੀਰ 'ਚ ਫੀਲ ਹੁੰਦੀ ਹੈ ਅਤੇ ਆਹੀ ਦੌੜਨ ਦੇ ਫਾਇਦੇ ਨੇ ਧੰਨਿਆਵਾਦ